ਅਸੀਂ ਮੌਜੂਦਾ ਪੌਦਿਆਂ ਤੋਂ ਹੋਰ ਪੌਦੇ ਪੈਦਾ ਕਰਨ ਲਈ ਵੀ ਕਈ ਤ ਕਈ ਤਕਨੀਕਾਂ ਦੀ ਵਰਤੋਂ ਕਰਦੇ ਹਾਂ ਅਤੇ ਉਹਨਾਂ ਪੌਦਿਆਂ ਨਾਲ ਲਈ ਅੱਗੇ ਵਧਾਉਣ ਵਧਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਜਿਵੇਂ ਮਨੀ ਪਲਾਟ ਦਾ ਪੌਦਾ ਇਹ ਜਿਵੇਂ ਇੱਕ ਓਹ ਗਮਲੇ ਵਿੱਚ ਫੈਲ ਜਾਂਦਾ ਵਧ ਜਾਂਦਾ ਫਿਰ ਅਸੀਂ ਇੱਕ ਗਮਲੇ ਤੋਂ ਦੂਜੇ ਗਮਲੇ ਵਿੱਚ ਲਾਉਂਦੇ ਹਾਂ ਉਹਦੇ ਲਗਾਉਣ ਵਾਸਤੇ ਉਹਦਾ ਕੀ ਕਰਦੇ ਹਾਂ ਉਹਦੀ ਕਲਮ ਕੱਢ ਲੈਂਦੇ ਹਾਂ ਕਲਮ ਕੱਢ ਕੇ ਦੂਜੇ ਪੌਦੇ ਵਿੱਚ ਗਮਲੇ ਵਿੱਚ ਲਗਾ ਦਿੰਦੇ ਉਹ ਹੌਲੀ ਹੌਲੀ ਚੱਲਣਾ ਸ਼ੁਰੂ ਹੋ ਜਾਂਦਾ ਅਤੇ ਚੱਲ ਪੈਂਦਾ ਜਿਵੇਂ ਫਿਰ ਗ ਗੁਲਾਬ ਦਾ ਪੌਦਾ ਲਗਾ ਲਿਆ ਇੱਕ ਸਮਝ ਲਓ ਉਹ ਲੱਗ ਗਿਆ ਖਿੜ੍ਹ ਗਿਆ ਚੰਗੀ ਤਰ੍ਹਾਂ ਉਹਨੂੰ ਅੱਗੇ ਅੱਗੇ ਹੋਰ ਇੱਕ ਤੋਂ ਦੂਜਾ ਪੌਦਾ ਬਣਾਉਣ ਵਾਸਤੇ ਉਸੇ ਦੀ ਕਲਮ ਕੱਢ ਕੇ ਦੂਜੇ ਪੌਦੇ ਜਗ੍ਹਾ 'ਤੇ ਲਗਾਇਆ ਜਾਂਦਾ ਉਹ ਪੌਦਾ ਬਣ ਜਾਂਦਾ ਇਸ ਤਰ੍ਹਾਂ ਪੌਦਿਆਂ ਦੀਆਂ ਤਕਨੀਕਾਂ ਨੂੰ ਵਧਾਈ ਜਾਂਦੇ ਹਾਂ ਅਸੀਂ ਪਰ ਅੱਗੇ ਦੀ ਅੱਗੇ ਲਗਾਈ ਜਾਂਦੇ ਹਾਂ ਉਸ ਤੋਂ ਬਾਅਦ ਜਿਵੇਂ ਹੁਣ ਪੌਦਾ ਪੌਦਾ ਗੁਲਾਬ ਦਾ ਲਗਾ ਲਿਆ ਗੁਲਾਬ ਦਾ ਪੌਦਾ ਵੀ ਇਸੇ ਤਰ੍ਹਾਂ ਵਧਾਉਂਦੇ ਰਹਿੰਦੇ ਹਾਂ ਅਸੀਂ ਇੱਕ ਤੋਂ ਦੋ ਕਰਤੇ ਦੋ ਤੋਂ ਤਿੰਨ ਕਰਤੇ ਜਿਵੇਂ ਕਲਮਾਂ ਕੱਢੀ ਜਾਂਦੇ ਹਾਂ ਅੱਗੇ ਤੋਂ ਅੱਗੇ ਲਗਾਈ ਜਾਂਦੇ ਹਾਂ ਵਧਾਈ ਜਾਂਦੇ ਹਾਂ ਪੌਦੇ ਬਹੁਤ ਸੋਹਣੇ ਲੱਗਦੇ ਆ ਲਾਏ